ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਇੱਥੇ ਬਥੇਰੀਆਂ ਸਕੋਲਰਸ਼ਿਪਾਂ ਹਨ ਜੋ ਵੀ ਵਿਦਿਆਰਥੀਆਂ ਨੂੰ ਮਿਲਦੀ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਬੱਚਿਆਂ ਨੂੰ ਜੇਕਰ ਆਪਾਂ ਸਕੂਲ ਵਿੱਚ ਪਾਉਂਦੇ ਹਾਂ ਤਾਂ ਕਿਸੇ ਹੋਰ ਕਲਾਸ ਕਾਲਜ ਵਿੱਚ ਵਿੱਚ ਉੱਥੇ ਬਥੇਰੀ ਸਕੋਲਰਸ਼ਿਪ ਦਿੱਤੀ ਜਾਂਦੀ ਹੈ ਜਿਵੇਂ ਕਿ ਆਪਾਂ ਕਾਲਜ ਦੀ ਉਦਾਹਰਨ ਦੇ ਲੈ ਲਈਏ ਜਦੋਂ ਵੀ ਬੱਚਾ ਕਾਲਜ ਵਿੱਚ ਜ ਦਾਖਲਾ ਲੈਂਦਾ ਅਤੇ ਪਹਿਲਾਂ ਉਹਦਾ ਮੈਰਿਟ ਬੇਸ ਚੈੱਕ ਕੀਤਾ ਜਾਂਦਾ ਜੇਕਰ ਬੱਚਾ ਮੈਰਿਟ ਬੇਸ ਵਿੱਚ ਵਧੀਆ ਨੰਬਰ ਲੈ ਕੇ ਆਉਂਦਾ ਪਰ ਸਰਕਾਰ ਦੇ ਉਹਨਾਂ ਨੂੰ ਸਕਾਲਰਸ਼ਿਪ ਦਿੰਦੀ ਆ ਉਹਨਾਂ ਦੇ ਨੰਬਰਾਂ ਦੇ ਅਧਾਰ 'ਤੇ ਕੁਝ ਬੱਚਿਆਂ ਨੂੰ ਦੇ ਮਾਪੇ ਨਹੀਂ ਹੁੰਦੇ ਉਹਨਾਂ ਨੂੰ ਉਸ ਹਿਸਾਬ ਨਾਲ਼ ਉਹਨਾਂ ਨੂੰ ਸਕੋਲਰਸ਼ਿਪ ਮਿਲਦੀ ਹੈ ਕਿ ਉਹਨਾਂ ਦੇ ਮਾਪੇ ਨਹੀਂ ਗੇ ਨਹੀਂ ਗੇ ਅਤੇ ਉਹਨਾਂ ਨੂੰ ਪੜ੍ਹਨ ਦਾ ਸ਼ੌਂਕ ਪਰ ਪਰ ਪੜ੍ਹ ਨਹੀਂ ਸ ਪਾ ਰਹੇ ਕਿ ਫੀਸ ਕਿੱਧਰੋਂ ਜਾਏਗੀ ਪਰ ਸਰਕਾਰ ਉਹਨਾਂ ਦੀ ਮਦਦ ਕਰਦੀ ਹੈ ਉਹਨਾਂ ਨੂੰ ਵੀ ਸਕਾਲਰਸ਼ਿਪ ਦਿੰਦੀ ਹੈ ਹੋਰ ਕੁਝ ਅਤੇ ਵਿਅੰਗ ਵਿਅਕਤੀਆਂ ਵਾਸਤੇ ਵੀ ਕਾਫ਼ੀ ਸਕਾਲਰਸ਼ਿਪ ਨੇ ਜੋ ਸਰਕਾਰ ਨੇ ਦਿੱਤੀ ਏ ਹੋਈ ਹੈ ਅਤੇ ਹੋਰ ਵਿਦਿਆਰਥਣਾਂ ਲਈ ਕਈ ਲਈ ਕਿ ਵੀ ਕਾਫ਼ੀ ਸਕੋਲਰਸ਼ਿਪ ਹੈ ਜਿਵੇਂ ਕਿ ਵਿਦਿਆਰਥਣਾਂ ਲਈ ਹੋਣੀ ਵੀ ਚਾਹੀਦੀ ਇੱਕ ਵਿਦਿਆਰਥਣ ਦੀ ਸਮਾਜ ਦਾ ਹਿੱਸਾ ਉਹਨਾਂ ਨੂੰ ਵੀ ਪੜ੍ਹਨ ਦਾ ਹੱਕ ਹੈ ਉਹਨਾਂ ਲਈ ਜਿਵੇਂ ਇੱਕ ਪਿੱਛੇ ਜੇ ਸਕਾਲਰਸ਼ਿਪ ਆਈ ਸੀ ਜੋ ਬਾਦਲ ਸਰਕਾਰ ਨੇ ਰਾਜ ਵਿੱਚ ਸੀਗੀ ਸੀ ਕਿ ਬੱਚਿਆਂ ਨੂੰ ਮੁਫ਼ਤ ਐਜੂਕੇਸ਼ਨ ਦੇਣੀ ਸਾਰੇ ਬੱਚਿਆਂ ਨੂੰ ਸਾਈਕਲ ਵੰਡੇ ਉਹਨਾਂ ਨੇ ਉਹਨਾਂ ਨੂੰ ਲੈਪਟੋਪ ਵੰਡੇ ਉਹਨਾਂ ਨੂੰ ਮੋਬਾਇਲ ਫ਼ੋਨ ਵੰਡੇ ਤਾਂ ਕਿ ਬੱਚੇ ਪੜ੍ਹ ਸਕਣ ਕਿਉਂਕਿ ਬੱਚੇ ਹੀ ਤਾਂ ਦੇਸ਼ ਦਾ ਭਵਿੱਖ ਹਨ ਬੱਚੇ ਵਧੀਆ ਸਿੱਖਿਆ ਲੈਣਗੇ ਅਤੇ ਉਹ ਵਧੀਆ ਅੱਗੋਂ ਮਤਲਬ ਦਿਖਾਉਣਗੇ ਅਤੇ ਸਮਾਜ ਨੂੰ ਗਿਆਨ ਜੀ ਆਪਾਂ ਪੜ੍ਹਿਆ ਹੈ ਪੜ੍ਹਿਆ ਅਤੇ ਉਹ ਹੁਣ ਆਪਾਂ ਸਮਾਜ ਦਾ ਭਲਾ ਕਰਨਾ ਅਤੇ ਕੁਝ ਹੋਰ ਪ੍ਰਕਾਰ ਦੀਆਂ ਵੀ ਸਕਾਲਰਸ਼ਿਪ ਹਨ ਜਿੱਦਾਂ ਡਾਕਟਰ ਅੰਬੇਦਕਰ ਸਕੋਲਰਸ਼ਿਪ ਕਮਿਸ਼ਨ ਇ ਇੰਡੀਆ ਫਾਊਡਰੇਸ਼ਨ ਸਕੋਲਰਸ਼ਿਪ ਆਦਿ ਹੋਰ ਪ ਕਈ ਪ੍ਰਕਾਰ ਦੀਆਂ ਸਕੋਲਰਸ਼ਿਪ ਹਨ ਜੋ ਕਿ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਹਨ ਧੰਨਵਾਦ ਜੀ